ਹੈਲੋ ਹਾਂਜੀ ਸਰ ਕਿਆ ਹਾਲ ਹੈ ਜੀ ਅਤੇ ਮੈਂ ਸਰ ਜਿੰਮ ਲੱਗਣਾ ਸੀਗਾ ਆਪਣਾ ਹਿੱਟ ਹਿਟ ਤੋਂ ਗੱਲ ਕਰ ਰਹੇ ਜੀ ਹਿੱਟ ਜਿੰਮ ਤੋਂ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਅਤੇ ਮੈਂ ਸਰ ਆਪਣੀ ਟ੍ਰੇਨਿੰਗ ਲੈਣੀ ਆ ਉੱਥੋਂ ਜਿੰਮ ਤੋਂ ਆਪਣਾ ਲਾਉਣਾ ਹੁਣ ਟਾਈਮ ਅਤੇ ਕਿੱਦਾਂ ਆਪਣਾ ਹਿਸਾਬ ਕਿਤਾਬ ਕਿੱਦਾਂ ਜੀ ਜਿੰਮ ਦਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਵੈਸੇ ਮੈਂ ਡਿਊਟੀਆਂ ਦੇ ਕਰਕੇ ਮੈਨੂੰ ਸ਼ਿਫਟਾਂ 'ਚ ਆਉਣਾ ਪੈਂਦਾ ਜੀ ਤਾਂ ਫਿਰ ਮੈਂ ਉਸ ਹਿਸਾਬ ਨਾਲ ਦੇਖ ਲੂਗਾ ਵੀ ਕਿਵੇਂ ਆਉਣਾ ਸਵੇਰੇ ਆਉਣਾ ਕਿ ਸ਼ਾਮ ਨੂੰ ਆਉਣਾ ਜੀ ਅਤੇ ਮੈਨੂੰ ਮੈਂ ਆਪਣਾ ਵਰਕਆਊਟ ਚੰਗਾ ਕਰਨਾ ਜਿਵੇਂ ਮਿਸ ਨਾ ਪਵੇ ਮੇਰਾ ਅਤੇ ਤੁਸੀਂ ਉਸ ਹਿਸਾਬ ਨਾਲ ਮੈਨੂੰ ਪੂਰਾ ਸਟ੍ਰਿਕਟ ਰੱਖਿਉ ਠੀਕ ਹੈ ਜੀ ਠੀਕ ਹੈ ਜੀ ਥੋੜ੍ਹਾ ਜਿਹਾ ਲੈਗ ਡੇ ਤੋਂ ਮੈਂ ਇੱਕ ਥੋੜ੍ਹਾ ਜਿਹਾ ਲੈਗ ਡੇ ਤੋਂ ਘਬਰਾਉਂਦਾ ਜੀ ਮੈਂ ਬਾਕੀ ਦੇਖ ਲਿਓ ਹਾਂ ਹਾਂ ਹਾਂ ਹਾਂ ਠੀਕ ਹੈ ਜੀ ਠੀਕ ਹੈ ਜੀ ਅਤੇ ਹਾਂਜੀ ਹਾਂਜੀ ਫੀਸ ਕਿੰਨੀ ਹੈ ਜੀ ਆਪਣੀ ਠੀਕ ਹੈ ਜੀ ਜੇ ਆਪਾਂ ਮਤਲਬ ਵੀ ਇਕੱਠੀ ਕਰਵਾਉਣੀ ਹੋਵੇ ਤਿੰਨ ਮਹੀਨਿਆਂ ਦੀ ਹੈ ਕੋਈ ਕਨਸੈਸ਼ਨ ਅੱਛਾ ਅੱਛਾ ਅੱਛਾ ਜੀ ਚਲੋ ਐਂ ਕਰੂੰਗਾ ਜੀ ਫਿਰ ਮੈਂ ਤੁਹਾਡੇ ਕੋਲ ਆਊਂਗਾ ਜੀ ਅਤੇ ਉੱਥੇ ਆ ਕੇ ਫਿਰ ਆਪਾਂ ਨਾਲੇ ਹੋਰ ਗੱਲਬਾਤ ਕਰ ਲਵਾਂਗੇ ਜੀ ਨਾਲ ਦੋ ਮੁੰਡੇ ਹੋਰ ਵੀ ਨੇ ਉਹ ਵੀ ਰਖਵਾਉਣੇ ਨੇ ਮੈਂ ਠੀਕ ਹੈ ਜੀ ਮੈਂ ਬਾਕੀ ਦੇਖਦਾ ਅੱਜ ਤਾਂ ਜੀ ਚਲੋ ਸ਼ਨੀਵਾਰ ਆ ਗਿਆ ਅਤੇ ਕੱਲ੍ਹ ਨੂੰ ਮੈਨੂੰ ਲੱਗਦਾ ਸੰਡੇ ਆ ਗਿਆ ਜੀ ਅਤੇ ਪਰਸੋਂ ਨੂੰ ਖੁੱਲੂ ਹੁਣ ਹੈ ਨਾ ਜੀ ਸੰਡੇ ਨੂੰ ਤਾਂ ਫਿਰ ਛੁੱਟੀ ਰੈਸਟ 'ਤੇ ਹੋਊਗਾ ਕੰਮ ਹੈ ਨਾ ਅਤੇ ਆਪਣੇ ਕੋਲ ਉਹ ਤਾਂ ਨਹੀਂ ਹੈਗਾ ਜੀ ਕੰਮ ਦੂਜਾ ਉਹ ਸਟੀਮ ਵਾਲਾ ਠੀਕ ਆ ਠੀਕ ਆ ਜੀ ਠੀਕ ਆ ਜੀ ਬਾਅਦ 'ਚ ਸਰੀਰ ਰਿਲੈਕਸ ਜਿਹਾ ਹੋ ਜਾਂਦਾ ਫਿਰ ਠੀਕ ਹੈ ਓਕੇ ਜੀ ਓ ਥੈਂਕ ਯੂ